ਜੀ ਹਾਂ ਮੇਰੇ ਵਿਹੜੇ ਅਤੇ ਬਾਗ ਵਿੱਚ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਇਹ ਸੁਝਾਵ ਹੈ ਕਿ ਮੇਰਾ ਘਰ ਬਹੁਤ ਵੱਡਾ ਹੈ ਅਤੇ ਮੇਰੇ ਘਰ ਦੇ ਬਾਹਰ ਨਾ ਮੇਰਾ ਬਾਗ ਹੈ ਖੁਦ ਦਾ ਠੀਕ ਆ ਅਤੇ ਮੇਰੇ ਘਰ ਦੇ ਉੱਤੇ ਨਾ ਮੈਂ ਪੰਛੀਆਂ ਵਾਸਤੇ ਕੁਝ ਥਾਂ ਬਣਾਈ ਹੋਈ ਹੈ ਅਤੇ ਜਿਸ ਉੱਤੇ ਆ ਕੇ ਉਹ ਬੈਠ ਸਕਣ ਆਰਾਮ ਕਰ ਸਕਣ ਅਤੇ ਪੰਛੀਆਂ ਵਾਸਤੇ ਮੈਂ ਖਾਣ ਪੀਣ ਦਾ ਵੀ ਕੋਠੇ ਉੱਤੇ ਰੇਂਜਮੈਂਟ ਕੀਤਾ ਹੋਇਆ ਉਹਨਾਂ ਵਾਸਤੇ ਦਾਣੇ ਪਾਏ ਅਤੇ ਪਾਣੀ ਰੱਖਿਆ ਹੋਇਆ ਕਿ ਉਹ ਆ ਕਰ ਆਪਣਾ ਖਾਣਾ ਪੀਣਾ ਕਰਨ ਅਤੇ ਪਾਣੀ ਪੀ ਲੈਣ ਕਿਉਂਕਿ ਪੰਛੀ ਵੀ ਇੱਕ ਜੀਵ ਹੈ ਅਤੇ ਮੇਰੇ ਬਾਗ ਵਿੱਚ ਬਹੁਤ ਜ਼ਿਆਦਾ ਮੈਂ ਪੇੜ ਲਗਾਏ ਹਨ ਅਤੇ ਫਲ ਫਰੂਟਸ ਅਤੇ ਕਿਉਂਕਿ ਪੰਛੀਆਂ ਨੂੰ ਵੀ ਫਲ ਫਰੂਟਸ ਖਾਣੇ ਪਸੰਦ ਹੈ ਸਬਜੀਆਂ ਮਿਰਚਾਂ ਵਗੈਰਾ ਵੀ ਪਸੰਦ ਹੁੰਦੇ ਹਨ ਤਾਂ ਕਰਕੇ ਮੈਂ ਫਲ ਫਰੂਟ ਦੇ ਪੇੜ ਲਗਾਏ ਹਨ ਅਤੇ ਪੇੜਾਂ ਉੱਤੇ ਮੈਂ ਉਹਨਾਂ ਦਾ ਉਹਨਾਂ ਦੇ ਰਹਿਣ ਵਾਸਤੇ ਘਰ ਵੀ ਬਣਾਇਆ ਅਤੇ ਘੋਸਲਾ ਵੀ ਬਣਾ ਕੇ ਰੱਖੇ ਹੋਏ ਆ ਕਿ ਉਹ ਆਉਣ ਅਤੇ ਰਹਿਣ ਇੱਥੇ ਅਤੇ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਮੈਂ ਲੋਕਾਂ ਨੂੰ ਮੋਟੀਵੇਟ ਕੀਤਾ ਲੋਕਾਂ ਨੂੰ ਦੱਸਿਆ ਹੈ ਕਿ ਉਹਨਾਂ ਨੂੰ ਖਾਣ ਪੀਣ ਦਾ ਰੱਖਣਾ ਚਾਹੀਦਾ ਆਪਣੇ ਛੱਤ ਉੱਤੇ ਪਾਣੀ ਪੂਣੀ ਦੇਣਾ ਚਾਹੀਦਾ ਅਤੇ ਜਦੋਂ ਮੈਂ ਕੋਲਜ ਜਾਂਦਾ ਅਤੇ ਕੋਲਜ ਵਿੱਚ ਵੀ ਮੈਂ ਇੱਕ ਸਰ ਨਾਲ ਗੱਲ ਕਰਕੇ ਹਰ ਥਾਂ 'ਤੇ ਪੰਛੀਆਂ ਵਾਸਤੇ ਦਾਣੇ ਰਖਵਾਏ ਹੋਏ ਹਾਂ ਪਾਣੀ ਰਖਵਾਇਆ ਹੋਇਆ ਅਤੇ ਸਾਡੇ ਕੋਲਜ ਵਿੱਚ ਇੱਕ ਜੰਗਲ ਹੈ ਜੰਗਲ ਵਿੱਚ ਨਾ ਕਾਫ਼ੀ ਘੋਸਲੇ ਵਗੈਰਾ ਬਣਾਏ ਹੋਏ ਨੇ ਅਤੇ ਘਰ ਵਗੈਰਾ 'ਤੇ ਜਿਸ ਕਰਕੇ ਪੰਛੀ ਦੀ ਚਾਹਟ ਰਹਿੰਦੀ ਅਤੇ ਸਾਨੂੰ ਮੈਡੀਟੇਸ਼ਨ ਵਗੈਰਾ ਵਿੱਚ ਹੈਲਪ ਮਿਲਦੀ ਹੈ ਸਾਨੂੰ ਬਹੁਤ ਰਿਲੈਕਸ ਫੀਲ ਹੁੰਦਾ ਪੰਛੀਆਂ ਦੀ ਆਵਾਜ਼ਾਂ ਨਾਲ ਜੀ ਹਾਂ ਮੈਂ ਪੰਛੀਆਂ ਦੇ ਪੰਛੀਆਂ ਲਈ ਪਾਣੀ ਅਤੇ ਅਨਾਜ ਰੱਖਦਾ ਹਾਂ ਅਤੇ ਲੋਕਾਂ ਨੂੰ ਵੀ ਮੈਂ ਇਸ ਬਾਰੇ ਜਾਗਰੂਕਤਾ ਦਿੰਦਾ ਹਾਂ ਕਿ ਪੰਛੀਆਂ ਵਾਸਤੇ ਵੀ ਪਾਣੀ ਅਤੇ ਅਨਾਜ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਵੀ ਸਾਡੇ ਵਰਗੇ ਇੱਕ ਜੀਵ ਉਹਨਾਂ ਵਾਸਤੇ ਵੀ ਖਾਣਾ ਪੀਣਾ ਦੇਣਾ ਚਾਹੀਦਾ ਉਹਨਾਂ ਨੂੰ